ਜਲੰਧਰ ਜ਼ਿਲ੍ਹੇ ਵਿੱਚ ਮੁੱਖ ਖੇਤੀਬਾੜੀ ਉਤਪਾਦ ਦੀ ਜੇ ਅਸੀਂ ਗੱਲ ਕਰੀਏ ਤਾਂ ਜ਼ਿਆਦਾਤਰ ਲੋਕ ਕਣਕ ਸਬਜ਼ੀਆਂ ਦਾਲਾਂ ਵਗੈਰਾ ਦੀ ਖੇਤੀ ਕਰਦੇ ਹਨ ਕੁਝ ਲੋਕ ਆਪਣੇ ਘਰੇਲੂ ਵਰਤੋਂ ਲਈ ਕੁਛ ਕੁ ਸਬਜ਼ੀਆਂ ਘਰ ਉਗਾ ਲੈਂਦੇ ਹਨ ਇਹਨਾਂ ਨਾਲ ਕੀ ਹੁੰਦਾ ਕਿ ਕੀਟਨਾਸ਼ਕ ਜਿਹੜੇ ਹੈ ਉਹਨਾਂ ਦੀ ਖਤਰਾ ਉਹਨਾਂ ਦਾ ਘੱਟ ਰਹਿੰਦਾ ਅਤੇ ਪੁਰਾਣੇ ਸਮਿਆਂ ਵਿੱਚ ਸਿੰਚਾਈ ਦਾ ਕੰਮ ਨਹਿਰਾਂ ਖੂਹ ਕਰ ਦਿੰਦੇ ਸੀ ਅੱਜ ਕੱਲ੍ਹ ਟੈਕਨੋਲੋਜੀ ਹੈ ਟੈਕਨੋਲੋਜੀ ਦੇ ਨਾਲ ਇਨਸਾਨ ਦਾ ਵਿਅਕਤੀ ਦਾ ਸਮਾਂ ਅਤੇ ਜਿਹੜੀ ਮਿਹਨਤ ਹੈ ਉਹ ਬਹੁਤ ਬਚਦੀ ਹੈ ਜਿੱਥੇ ਪਹਿਲਾਂ ਖੂਹਾਂ ਦਾ ਜਾਂ ਨਹਿਰਾਂ ਦਾ ਇਸਤਮਾਲ ਕੀਤਾ ਜਾਂਦਾ ਸੀ ਉਥੇ ਅੱਜ ਕੱਲ੍ਹ ਮੋਟਰਾਂ ਨੇ ਉਹਨਾਂ ਦੀ ਜਗ੍ਹਾ ਲੈ ਲਈ ਹੈ ਮੋਟਰਾਂ ਦੇ ਨਾਲ ਖੇਤਾਂ ਵਿੱਚੋਂ ਪਾਣੀ ਜਿਹੜਾ ਇੱਕ ਕਾਫ਼ੀ ਜਗ੍ਹਾ ਦੇ ਵਿੱਚ ਪਾਣੀ ਪਹੁੰਚਾਉਣਾ ਇੱਕ ਆਸਾਨ ਕੰਮ ਹੋ ਚੁੱਕਾ ਹੈ ਅਤੇ ਅਗਰ ਆਪਾਂ ਜੇ ਅਸੀਂ ਗੱਲ ਕਰੀਏ ਕਿ ਟੈਕਨੋਲੋਜੀ ਦੀ ਵਰਤੋਂ ਟੈਕਨੋਲੋਜੀ ਦੀ ਵਰਤੋਂ ਹਰ ਖੇਤਰ ਵਿੱਚ ਖੇਤੀ ਦੇ ਹਰ ਰਸਤੇ ਦੇ ਵਿੱਚ ਕੀਤੀ ਜਾ ਰਹੀ ਹੈ ਬੀਜ ਬੀਜਣਾ ਕੀਟਨਾਸ਼ਕ ਦੀ ਵਰਤੋਂ ਬੀਜਾਂ ਨੂੰ ਕਿਸ ਤਰੀਕੇ ਨਾਲ ਪੁੰਗਰਣ ਦੇ ਲਈ ਵਾਧੇ ਦੇ ਲਈ ਹਰ ਤਰ੍ਹਾਂ ਦੀ ਅੱਜ ਕੱਲ੍ਹ ਜਿਹੜੇ ਕੈਮੀਕਲ ਯੂਸ ਕੀਤੇ ਜਾਂਦੇ ਹੈ ਕੁਛ ਕੈਮੀਕਲ ਜਿਹੜੇ ਵਧੀਆ ਚੀਜ਼ ਲਈ ਯੂਜ ਕੀਤੇ ਜਾਂਦੇ ਹੈ ਉਹਨਾਂ ਦੀ ਫ਼ਸਲ ਦੀ ਰੱਖ ਰਖਾਵ ਲਈ ਉਹ ਚੀਜ਼ਾਂ ਨੇ ਅੱਜ ਕੱਲ੍ਹ ਦੀ ਤਕਨੀਕ ਨਾਲ ਕਾਫ਼ੀ ਜ਼ਿਆਦਾ ਕਿਸਾਨਾਂ ਦੀ ਮਦਦ ਕੀਤੀ ਹੈ ਗਾਵਾਂ ਮੱਝਾਂ ਬੱਕਰੀਆਂ ਮੁਰਗੀਆਂ ਵਗੈਰਾ ਦਾ ਪਾਲਣ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਆਮ ਦੇਖਿਆ ਜਾਂਦਾ ਹੈ ਲੋਕਾਂ ਨੇ ਆਪਣੇ ਆ ਵਰਤੋਂ ਲਈ ਘਰੇਲੂ ਵਰਤੋ ਦੇ ਸਮਾਨ ਲਈ ਵੀ ਕਈ ਲੋਕਾਂ ਨੇ ਆਪਣੇ ਘਰ ਦੇ ਵਰਤਤੋਂ ਦੇ ਲਈ ਗਾਵਾਂ ਮੱਝਾਂ ਦਾ ਪਾਲਣ ਕੀਤਾ ਹੈ ਜਿਸ ਤੋਂ ਕਿ ਉਹਨਾਂ ਨੂੰ ਬਾਹਰੋਂ ਕਿਤੋਂ ਸਮਾਨ ਲੈਣਾ ਨਹੀਂ ਪੈਂਦਾ ਦੁੱਧ ਖਰੀਦਣਾ ਨਹੀਂ ਪੈਂਦਾ